ਹੈਲੋ ਨਮਸਕਾਰ ਜੀ ਦੇਖੋ ਜੀ ਮੈਂ ਗਾਹਕ ਬਹੁਤ ਬਣਾਏ ਹੈਗੇ ਹੈ ਮੇਰੇ ਜਿਹੜੇ ਬੈਂਕਫੀਡ ਮਿਲੀ ਹੈ ਮੈਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲਿਆ ਹੈਗਾ ਵਾ ਉਹ ਪਤਾ ਕਿੱਦਾਂ ਮਿਲਿਆ ਕਿ ਮੇਰੇ ਹੱਥ ਦਾ ਬਣਾਏ ਹੋਏ ਕੱਪੜੇ ਮੈਂ ਕੱਪੜੇ ਵਗੈਰਾ ਸਿਉਂਦੀ ਰਹੀ ਹਾਂ ਅਤੇ ਮੇਰੇ ਇੰਨੇ ਕੁ ਕੱਪੜਿਆਂ ਦੇ ਬਹੁਤ ਬਦ ਲੋਕ ਤਾਰੀਫ ਕਰਦੇ ਸੀ ਮੇਰੇ ਹੁਨਰ ਦੇ ਬਾਰੇ ਕਹਿੰਦੇ ਕਿ ਬਹੁਤ ਸੋਹਣਾ ਮੈਂ ਵੀ ਕਦੇ ਵੀ ਕੋਈ ਜਿੰਨੇ ਵੀ ਜ ਜਿਸ ਵੀ ਤਰ੍ਹਾਂ ਦੇ ਕੱਪੜੇ ਆਉਣੇ ਆ ਪਲਾਜੋ ਸੂਟ ਹੈ ਜੋ ਇਹ ਵੀ ਹੈ ਮੈਂ ਹੱਥ ਦਾ ਹੁਨਰ ਵੀ ਬਹੁਤ ਕੀਤਾ ਵਿਆ ਕਿਉਂਕਿ ਮੈਨੂੰ ਨੀਟਿੰਗ ਕਰਨੀ ਵੀ ਬਹੁਤ ਜ਼ਿਆਦਾ ਆਦਤ ਹੈ ਫਿਰ ਮੈਂ ਕੋਈ ਡਰਾਈਗਰਾਮ ਵਗੈਰਾ ਵੀ ਬਹੁਤ ਜਿਆਦਾ ਬਣਾ ਲੈਂਦੀ ਰਹੀ ਆਂ ਜਿਹੜੀ ਮਰਜ਼ੀ ਡਰਾਈਗਰਾਮ ਸਾਹਮਣੇ ਹੋਏ ਉਹਦਾ ਤਾਂ ਮੈਂ ਪੱਖੀਆਂ ਪੰਜਾਬੀ ਦੇ ਵਿੱਚ ਬਣਾਉਣੀਆਂ ਕੋਈ ਵੀ ਇੱਦਾਂ ਦਾ ਕੋਈ ਉਹ ਨਹੀਂ ਛੱਡਿਆ ਕੋਈ ਫਲਾਵਰ ਵਗੈਰਾ ਬਣਾਉਣਾ ਕੋਈ ਬਾਸਕਿਟ ਵਗੈਰਾ ਬਣਾਉਣੀ ਆ ਜਾਂ ਕੋਈ ਕੋਈ ਵੀ ਮਤਲਬ ਸ਼ੋਪੀਸ ਬਣਾਉਣਾ ਮੈਨੂੰ ਬਹੁਤ ਜ਼ਿਆਦਾ ਇੰਟਰਸਟ ਸੀਗਾ ਆਪਣੇ ਹੁਨਰ ਦੇ ਉੱਪਰ ਕਿਉਂਕਿ ਮੈਂ ਖੁਦ ਕਰਨਾ ਪਸੰਦ ਕਰਦੀ ਸੀ ਫਿਰ ਮੈਨੂੰ ਇਹਦਾ ਸਿਲਾਈ ਦਾ ਬਹੁਤ ਜ਼ਿਆਦਾ ਸੀਗਾ ਸਿਲਾਈ ਦੇ ਮੈਂ ਕੋਈ ਦਿਨ ਐਸਾ ਨਹੀਂ ਜਾਣ ਦੇਣਾ ਜਿਸ ਦਿਨ ਮੈਂ ਮਸ਼ੀਨ ਨਹੀਂ ਡਾਹੁਣੀ ਹਰ ਰੋਜ਼ ਮੈਂ ਮਸ਼ੀਨ ਡਾਹ ਕੇ ਕੰਮ ਕਰਨਾ ਹੀ ਕਰਨਾ ਜੋ ਮਰਜ਼ੀ ਹੋਵੇ ਹਾਂ ਜੋ ਮਰਜ਼ੀ ਹੋਵੇ ਮੈਂ ਕੰਮ ਕਰਨਾ ਹੀ ਕਰਨਾ ਭਾਵੇਂ ਦੋ ਸੂਟ ਇੱਕ ਸੂਟ ਯਾਨੀ ਦਿਨ ਦਾ ਕੱਢਣਾ ਹੀ ਕੱਢਣਾ ਹੁੰਦਾ ਸੀਗਾ ਮੈਨੂੰ ਇੰਨਾ ਪਿਆਰ ਸੀਗਾ ਆਪਣੇ ਹੁਨਰ 'ਤੇ ਔਰ ਮੇਰੇ ਜਿਹੜੇ ਗਾਹਕ ਸੀ ਉਹ ਵੀ ਮੇਰੀ ਚੀਜ਼ ਨੂੰ ਦੇਖ ਕੇ ਬਹੁਤ ਜ਼ਿਆਦਾ ਮਤਲਬ ਲਾਈਕ ਕਰਦੇ ਸੀ ਪਸੰਦ ਕਰਦੇ ਸੀ ਕਿ ਮੈਂ ਦੀਦੀ ਤੁਹਾਡੇ ਕੋਲੋਂ ਹੀ ਸਵਾਉਣਾ ਹੈ ਤੁਸੀਂ ਬਹੁਤ ਵਧੀਆ ਸੀਤਾ ਹੈ ਮੇਰੇ ਲਾਗੇ ਮੇਰੇ ਸਟੂਡੈਂਟਸ ਸੀਗੇ ਸਕੂਲ ਦੇ ਸਟੂਡੈਂਟ ਸੀ ਲੈਕਚਰਾਰ ਲੱਗੇ ਹੋਏ ਸੀ ਉਹਨੇ ਕਹਿਣਾ ਕਰਨਾ ਦੀਦੀ ਮੈਂ ਤੇਰੇ ਕੋਲੋਂ ਹੀ ਸੂਟ ਸਵਾਉਣਾ ਹੈਗਾ ਵਾ ਤੁਸੀਂ ਜਿੱਦਾ ਮਰਜ਼ੀ ਕਰੋ ਮੈਂ ਤੁਹਾਡੇ ਕੋਲ ਸਵਾਉਣਾ ਮੈਨੂੰ ਤੁਹਾਡੀ ਬਹੁਤ ਜ਼ਿਆਦਾ ਫਿਟਿੰਗ ਪਸੰਦ ਹੈ ਮੈਨੂੰ ਤੁਹਾਡਾ ਬਹੁਤ ਸੋਹਣਾ ਕੰਮ ਪਸੰਦ ਹੈ ਤੁਸੀਂ ਬਿਲਕੁਲ ਸਹੀ ਕੰਮ ਕਰਦੇ ਅਤੇ ਮੈਨੂੰ ਬਾਕੀਆਂ ਦਾ ਕੋਈ ਇੰਨਾ ਜਾਂ ਚੀਜ਼ ਪਾਈ ਹੋਈ ਪਸੰਦ ਨਹੀਂ ਆਉਂਦੀ ਜਿੰਨੀ ਤੁਹਾਡੀ ਆਉਂਦੀ ਹੈ ਹਾਂਜੀ ਮੇਰੇ ਹੁਨਰ ਦੇ ਬਾਰੇ ਇਹ ਹੀ ਮੈਂ ਤੁਹਾਨੂੰ ਦੱਸ ਰਹੀ ਓਕੇ